ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਹੀ ਦੌਰ ਹੈ ਸੋਸ਼ਲ ਮੀਡੀਆ ਰਾਹੀਂ ਅਸੀਂ ਕੁਛ ਵੀ ਕਰ ਸਕਦੇ ਹਾਂ ਦੂਰ ਤੋਂ ਦੂਰ ਬੈਠੇ ਆਪਣੇ ਦੋਸਤ ਰਿਸ਼ਤੇਦਾਰ ਨਾਲ ਗੱਲਬਾਤ ਕਰ ਸਕਦੇ ਹਾਂ ਉੱਦਾਂ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਲੋਕਾਂ ਨੂੰ ਕਲਾ ਅਤੇ ਸ਼ਿਲਪਕਾਰੀ ਵਿੱਚ ਸ਼ਾਮਲ ਹੋਣ ਵਿੱਚ ਮਦਦ ਵੀ ਕੀਤੀ ਹੈ ਜਿਵੇਂ ਕਿ ਅੱਜ ਅਸੀਂ ਘਰ ਬੈਠੇ ਹੀ ਕੁਛ ਨਾ ਕੁਛ ਸਿੱਖ ਸਕਦੇ ਹਾਂ ਯੂਟੀਊਬ ਚੈਨਲ ਵੀ ਬਹੁਤ ਹੀ ਜ਼ਿਆਦਾ ਸਹਾਇਕ ਰਿਹਾ ਹੈ ਕਿਉਂਕਿ ਪਹਿਲਾਂ ਤਾਂ ਲੋਕਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਪੈਂਦੀ ਸੀ ਜੋ ਲੋਕ ਗਰੀਬ ਸਨ ਪਰ ਸਿੱਖਣ ਦੇ ਇਛੁੱਕ ਸਨ ਉਹ ਕੁਛ ਸਿੱਖ ਨਹੀਂ ਪਾਉਂਦੇ ਸਨ ਪਰ ਅੱਜ ਕੱਲ੍ਹ ਹਰ ਹੱਥ ਵਿੱਚ ਕੋਈ ਨਾ ਕੋਈ ਕਲਾ ਹੈ ਅਤੇ ਉਹ ਆਰਾਮ ਨਾਲ ਕਦੇ ਵੀ ਜਿੱਥੇ ਮਰਜ਼ੀ ਬੈਠੇ ਕੁਛ ਵੀ ਸਿੱਖ ਸਕਦੇ ਹਨ ਜਿਸ ਕਾਰਨ ਇਹ ਮੰਨਿਆ ਜਾਂਦਾ ਕਿ ਸੋਸ਼ਲ ਮੀਡੀਆ ਦੇ ਬਹੁਤ ਹੀ ਲਾਭ ਹਨ ਅਤੇ ਯੂਟੀਊਬ ਵੀ ਬਹੁਤ ਹੀ ਇੱਕ ਵਧੀਆ ਜ਼ਰੀਆ ਹੈ ਸਿੱਖਣ ਦਾ ਹਾਂ ਬਹੁਤ ਯੂਟਿਊਬ ਚੈਨਲ ਜਿਵੇਂ ਕਿ ਆਰਟ ਐਂਡ ਕਰਾਫਟ ਵਾਲੇ ਕੁਕਿੰਗ ਵਾਲੇ ਜਾਂ ਹੋਰ ਵੀ ਡਰਾਇੰਗ ਵਾਲੇ ਬਹੁਤ ਚੈਨਲ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਬਹੁਤ ਹੀ ਕੁਛ ਸਿੱਖ ਸਕਦੇ ਹਨ ਆਹ ਯੂਟਿਊਬ ਚੈਨਲ ਲੋਕਾਂ ਦੀ ਕਮਾਈ ਦਾ ਸਾਧਨ ਵੀ ਹੈ ਜਿਨਾਂ ਦੇ ਹੱਥ ਵਿੱਚ ਕਲਾ ਹੈ ਉਹ ਘਰ ਬੈਠੇ ਹੀ ਕੁਛ ਨਾ ਕੁਛ ਸਿਖਾ ਵੀ ਸਕਦੇ ਹਨ ਅਤੇ ਸਿੱਖਣ ਵਾਲੇ ਵੀ ਕੁਛ ਮਰਜ਼ੀ ਸਿੱਖ ਸਕਦੇ ਹਨ ਕੋਈ ਵੀ ਪਾਬੰਦੀ ਕੋਈ ਰੋਕ ਟੋਕ ਕਿਸੇ 'ਤੇ ਨਹੀਂ ਹੈ ਅਤੇ ਬਾਹਰ ਜਾਣ ਦਾ ਵੀ ਰੌਲਾ ਬਿਲਕੁਲ ਵੀ ਨਹੀਂ ਹੈ ਇਸ ਕਰਕੇ ਅੱਜ ਸੋਸ਼ਲ ਮੀਡੀਆ ਬਹੁਤ ਹੀ ਲਾਭਦਾਇਕ ਹੈ ਇਹਨਾਂ ਚੀਜ਼ਾਂ ਵਾਸਤੇ